ਬਾਈਕ ਚਲਾਉਣਾ ਕੋਈ ਔਖੀ ਗੱਲ ਨਹੀਂ ਬਾਈਕ ਚਲਾਉਣਾ ਹਰ ਕੋਈ ਸਿੱਖ ਸਕਦਾ ਹੈ ਜਿਹਨੇ ਕਦੇ ਸਾਈਕਲ ਚਲਾਉਣਾ ਸਿੱਖ ਲਿਆ ਤਾਂ ਉਹ ਬਾਈਕ ਚਲਾਉਣਾ ਵੀ ਸਿੱਖ ਸਕਦਾ ਹੈ ਬਾਈਕ ਚਲਾਉਣ ਨਾਲ ਬੰਦੇ ਦਾ ਆਤਮ ਵਿਸ਼ਵਾਸ ਵਧਦਾ ਹੈ ਅਤੇ ਉਹ ਸੋਚਦਾ ਹੈ ਕਿ ਮੈਂ ਜੇ ਮੈਂ ਬਾਈਕ ਚਲਾਉਣੀ ਸਿੱਖ ਲਈ ਹੈ ਤਾਂ ਮੈਂ ਹੋਰ ਅੱਗੇ ਗੱਡੀ ਚਲਾਉਣਾ ਵੀ ਸਿੱਖ ਸਕਦਾ ਹਾਂ ਕੁਝ ਨਵੇਂ ਬਾਈਕਰਸ ਕੁਝ ਗਲਤ ਕੁਝ ਆਮ ਗਲਤੀਆਂ ਕਰ ਦਿੰਦੇ ਹਨ ਜਿਨ੍ਹਾਂ ਕਾਰਨ ਉਹਨਾਂ ਨੂੰ ਕੁਝ ਸੱਟਾਂ ਸੱਟਾਂ ਦਾ ਵੀ ਹਾ ਹਾ ਸੱਟਾਂ ਨੂੰ ਵੀ ਝੇਲਣਾ ਪੈਂਦਾ ਹੈ ਅਤੇ ਹਾਦਸੇ ਵੀ ਦੇਖਣੇ ਪੈਂਦੇ ਨੇ ਉਹ ਗਲਤੀਆਂ ਨਾ ਦੌਰਾਨ ਇਸ ਕਰਕੇ ਸਰਕਾਰ ਨੇ ਕੁਝ ਨਿਯਮਾਂ ਨੂੰ ਰੱਖਿਆ ਹੈ ਜਿਵੇਂ ਕਿ ਬਾਈਕ ਚਲਾਉਂਦੇ ਵਕਤ ਹੈਲਮਟ ਦਾ ਸਿਰ ਤੇ ਉੱਤੇ ਪਾਉਣਾ ਬਹੁਤ ਜ਼ਰੂਰੀ ਹੈ ਅਤੇ ਬਾਈਕ ਦੀ ਛੋਟੀ ਜਾਂ ਵੱਡੀ ਗਲੀਆਂ ਵਿੱਚ ਜ਼ਿਆਦਾ ਰ ਤੇਜ਼ ਰਫਤਾਰ ਵਿੱਚ ਨਾ ਰੱਖਿਆ ਜਾਵੇ ਜਿਸ ਕਰਕੇ ਕੁੱਤੇ ਬਿੱਲੇ ਜਾਂ ਕਈ ਆ ਦੂਜੇ ਪੈਦਲ ਜਾਣ ਵਾਲੇ ਬੰਦਿਆਂ ਦੇ ਵੀ ਸੱਟ ਫੇਟ ਨਾ ਲੱਗੇ ਉਹ ਗਲਤੀਆਂ ਨੂੰ ਨਾ ਦੁਹਰਾਉਣ ਇਸ ਕਰਕੇ ਸਰਕਾਰ ਦੇ ਇਸ ਆਦਿ ਇਹ ਬਹੁਤ ਸਾਰੇ ਨਿਯਮਾਂ ਨੂੰ ਮੰਨਿਆ ਜਾਵੇ ਤਾਂ ਕਰਕੇ ਉਹ ਬਾਈਕਰ ਇੱਕ ਅਸਲੀ ਚੰਗਾ ਅਤੇ ਚੰਗਾ ਬਾਈਕਰ ਕਹਿਲਾਇਆ ਜਾਂਦਾ ਹੈ ਬਾਈਕਰਾਂ ਨੂੰ ਹਮੇਸ਼ਾ ਆਮ ਜਿਹੀਆਂ ਗਲਤੀਆਂ ਤੋਂ ਸੁਧਾ ਸੁਧਾਰ ਸਿੱਖਣਾ ਸੁਧਾਰ ਕਰਨਾ ਚਾਹੀਦਾ ਹੈ ਆਪਣੀ ਗਲਤੀਆਂ ਨੂੰ ਸਿੱਖਣਾ ਚਾਹੀਦਾ ਆਪਣੀ ਗਲਤੀਆਂ ਨੂੰ ਮੰਨਣਾ ਚਾਹੀਦਾ ਹੈ ਐਕਸੀਡੈਂਟ ਹਾਦਸਿਆਂ ਤੋਂ ਬਚਾਅ ਕਰਨ ਲਈ ਉਹ ਤੇਜ਼ ਰਫ਼ਤਾਰ ਨੂੰ ਨਾਲ ਨਾ ਦੇਖਣ ਹਮੇਸ਼ਾ ਸਲੋ ਚਲਾਉਣ ਨਿਯਮ ਅਨੁਸਾਰ ਚੱਲਦੇ ਰਹਿਣ ਆਪਣੇ ਹਰ ਨਿਯਮ ਦਾ ਸਖ਼ਤੀ ਨਾਲ ਪਾਲਣ ਕਰਨ ਅਤੇ ਬਾਈਕਰਸ ਸ਼ੁਰੂਆਤੀ ਗਲਤੀਆਂ ਨੂੰ ਨਾ ਦੁਹਰਾਉਣ